ਨੌ ਮਾਰਚ ਉੱਨੀ ਸੌ ਸਤਾਹਠ ਚੌਦਾਂ ਅਕਤੂਬਰ ਉੱਨੀ ਸੌ ਚਰੱਨਵੇ ਪੰਦਰਾਂ ਨਵੰਬਰ ਦੋ ਹਜ਼ਾਰ ਚਾਰ ਛੇ ਅਪ੍ਰੈਲ ਉੱਨੀ ਸੌ ਪਚੱਤਰ ਛੱਬੀ ਜਨਵਰੀ ਉੱਨੀ ਸੌ ਪੰਜਾਹ